ਹਾਂ ਅਸੀਂ ਪੰਜਾਬ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਨਿਆਂਪਾਲਿਕਾ ਦੀ ਭੂਮਿਕਾ ਦੀ ਵਿਆਖਿਆ ਵੀ ਕਰ ਸਕਦੇ ਹਾਂ ਅਤੇ ਇਹਨਾਂ ਦੀਆਂ ਰਾਜਪਾਲਿਕਾ ਕਾਰਜਪਾਲਿਕਾ ਵਿਧਾਨ ਸ਼ੇਖਾਵਾਂ ਦੀ ਸ਼ਕਤੀ ਨੁੂੰ ਸਹੀ ਤਰ੍ਹਾਂ ਕਿਵੇਂ ਸੰਤੁਲਿਤ ਕਰਦੀ ਹੈ ਇਹਦੇ ਬਾਰੇ ਵੀ ਦੱਸ ਸਕਦੇ ਹਾਂ ਪਿੰਡਾਂ ਵਿੱਚ ਗਰਾਮ ਪੰਚਾਇਤ ਹੁੰਦੀ ਹੈ ਅਤੇ ਸ਼ਹਿਰਾਂ ਵਿੱਚ ਨਿਆਂਪਾਲਿਕਾ ਹੁੰਦੀ ਹੈ ਜਿਹਦੇ ਵਿੱਚ ਕਿ ਲੋਕ ਜਾ ਕੇ ਆਪਣੀਆਂ ਮੁਸ਼ਕਿਲਾਂ ਨੂੰ ਦੱਸਦੇ ਹੈ ਅਤੇ ਉਹ ਆਪਣੀਆਂ ਟੀਮਾਂ ਭੇਜਦੇ ਹੈ ਜਿਹਦੇ ਨਾਲ ਕਿ ਉਹ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰ ਸਕਣ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਜਿਵੇਂ ਕਿ ਵੋਟਰ ਸਪਲਾਈ ਹੋ ਗਈ ਸੀਵਰੇਜ ਦੀ ਕੋਈ ਪ੍ਰੋਬਲਮ ਹੋ ਗਈ ਤਾਂ ਉਹ ਆਪਾਂ ਲੋਕ ਜਿਹੜੇ ਕਿ ਉਹਨਾਂ ਨੂੰ ਜਾ ਕੇ ਕੰਪਲੇਂਟ ਕਰਦੇ ਹੈ ਸਾਰੀਆਂ ਇਸ ਅਕੋਡਿੰਗ ਤਾਂ ਉਹ ਆਪਣੀ ਟੀਮ ਭੇਜ ਕੇ ਲੋਕਾਂ ਦੀ ਪ੍ਰੋਬਲਮ ਸੋਲਵ ਕਰ ਦਿੰਦੇ ਹੈ ਅਤੇ ਹੋਰ ਵੀ ਕਈ ਜਿਵੇਂ ਕੋਈ ਫੋਮ ਅਪਲਾਈ ਕਰਨੇ ਹੋਣ ਏ ਐਸ ਡਬਲਊ ਫੋਮ ਹੋ ਗਿਆ ਜਾਂ ਕੋਈ ਡੈਥ ਸਰਟੀਫਿਕੇਟ ਬਣਵਾਉਣਾ ਹੁੰਦਾ ਤਾਂ ਵੀ ਲੋਕ ਉੱਥੇ ਜਾ ਕੇ ਦੱਸਦੇ ਹੈ ਸੂਚਨਾ ਦਿੰਦੇ ਹੈ ਅਤੇ ਉਹ ਨਾਲ ਦੀ ਨਾਲ ਆਪਣਾ ਸਰਟੀਫਿਕੇਟ ਬਣਾ ਕੇ ਜਿਹੜਾ ਕਿ ਘਰ ਭੇਜ ਦਿੰਦੇ ਹੈ ਤਾਂ ਤੁਹਾਨੂੰ ਵਾਰ ਵਾਰ ਨਿਆਂਪਾਲਿਕਾ ਵਿੱਚ ਜਾ ਕੇ ਲੋਕਾਂ ਦੇ ਲੋਕਾਂ ਨੂੰ ਉੱਥੇ ਜਾ ਕੇ ਗੇੜੇ ਵੀ ਨਹੀਂ ਕੱਢਣੇ ਪੈਂਦੇ ਨਾ ਹੀ ਕਿਸੇ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਉਹ ਇੱਕ ਵਾਰੀ 'ਚ ਗੱਲ ਸੁਣ ਲੈਂਦੇ ਹੈ ਅਤੇ ਸਾਡਾ ਸਾਰਾ ਕੰਮ ਕਰ ਦਿੰਦੇ ਹੈ ਜਿਹਦੇ ਨਾਲ ਕੀ ਸਾਨੂੰ ਈਜਲੀ ਹਰ ਚੀਜ਼ ਪ੍ਰੋਵਾਇਡ ਹੋ ਜਾਂਦੀ ਹੈ ਅਤੇ ਸਾਡੀ ਹਰੇਕ ਪ੍ਰੋਬਲਮ ਜਿਹੜੀ ਕਿ ਸੋਲਵ ਹੋ ਜਾਂਦੀ ਹੈ ਅਤੇ ਜਿਹੜੇ ਡੋਕੂਮੈਂਟਸ ਵਗੈਰਾ ਅਸੀਂ ਬਣਵਾਉਂਦੇ ਹਾਂ ਉਹਦਾ ਤਾਂ ਸਾਨੁੂੰ ਅੱਗੇ ਜਾ ਕੇ ਬਹੁਤ ਫ਼ਾਇਦਾ ਹੁੰਦਾ ਹੈ ਅਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਕਾਰਜਪਾਲਿਕਾ ਅਤੇ ਵਿਧਾਨ ਸ਼ੇਖਾਵਾਂ ਹੈਗੀਆਂ ਉਹ ਆਪਣੀ ਹਰੇਕ ਸ਼ਕਤੀ ਨੂੰ ਬੜਾ ਵਧੀਆ ਸੰਤੁਲਨ ਕਰਕੇ ਰੱਖਦੇ ਹਨ